ਪੌਦੇ ਨੂੰ ਵਧਣ ਲਈ ਖਾਦ ਦੀ ਜ਼ਰੂਰਤ ਹੁੰਦੀ ਹੈ ਕਲੀਆਂ ਅਤੇ ਗੁਲਾਬ ਦੇ ਪੌਦੇ ਨੂੰ ਵੀ ਵਧਣ ਲਈ ਖਾਦ ਦੀ ਜ਼ਰੂਰਤ ਹੈ ਇਹਨਾਂ ਪੌਦਿਆਂ ਦੀ ਖਾਦ ਸਰਸੋਂ ਦੀ ਖੱਲ ਹੈ ਸਰਸੋਂ ਦੀ ਖੱਲ ਨੂੰ ਪਾਣੀ ਵਿੱਚ ਭਿਓਂ ਕੇ ਉਸਦੇ ਪਾਣੀ ਨੂੰ ਪਾਇਆ ਜਾਵੇ ਤਾਂ ਇਹ ਪੌਦੇ ਨੂੰ ਵਧਣ ਵਿੱਚ ਸਹਾਇਕ ਹੈ ਚਾਹ ਦੇ ਪੱਤੀ ਅਤੇ ਕੇਲੇ ਦੇ ਛਿਲਕੇ ਨੂੰ ਵੀ ਰਿੰਨ ਕੇ ਉਹਨਾਂ ਦੇ ਪਾਣੀ ਨੂੰ ਵੀ ਪੌਦੇ ਵਿੱਚ ਪਾਇਆ ਜਾਵੇ ਤਾਂ ਵੀ ਉਹ ਵਧਣ ਵਿੱਚ ਉਹਨਾਂ ਨੂੰ ਸਹਾਇਕ ਹੈ